ਪ੍ਰਮੁੱਖ ਗਤਕਾ ਮੁਕਾਬਲੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਅਤੇ ਏਸ਼ੀਅਨ ਗੱਤਕਾ ਚੈਂਪੀਅਨਸ਼ਿਪ ਅਤੇ ਵਰਲਡ ਗੱਤਕਾ ਚੈਪੀਅਨਸ਼ਿਪ ਵਿੱਚ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਇਸ ਨੂੰ ਲੋਕ ਉਸ ਉੱਥੇ ਮਾਰਸ਼ਲ ਆਰਟ ਬੋਲਦੇ ਹਨ ਓਲੰਪਿਕ ਵਿੱਚ ਵੀ ਇਹ ਖੇਡਾਂ ਨੂੰ ਖੇਡਿਆ ਜਾਂਦਾ ਹੈ ਇਹਦੇ ਵਿੱਚ ਸੋਟੀ ਫਰੀ ਸੋਟੀ ਫਰਾਈ ਅਤੇ ਉਹਦੀਆਂ ਫਾਈਟਾਂ ਹੁੰਦੀਆਂ ਹਨ ਦੋ ਬੰਦੇ ਆਪਸ ਵਿੱਚ ਭਿੜਦੇ ਹਨ ਅਤੇ ਇੱਕ ਰੈਫਰੀ ਵੀ ਹੁੰਦਾ ਹੈ ਰੈਫਰੀ ਕੋਲ ਹ ਲਾਲ ਕਾਰਡ ਅਤੇ ਗ੍ਰੀਨ ਕਾਰਡ ਹੁੰਦਾ ਜੇ ਕੋਈ ਫਾਊਲ ਕਰਦਾ ਰੈਫਰੀ ਉਹਨੂੰ ਰੈਡ ਪਹਿਲਾਂ ਵਾਰਨਿੰ ਵਾਰਨਿੰਗ ਦਿੰਦਾ ਇਤਲਾਹ ਕਰਦਾ ਹੈ ਅਤੇ ਬਾਅਦ ਵਿੱਚ ਅਗਰ ਦੂਸਰੀ ਤੀਸਰੀ ਵਾਰ ਫਾਊਲ ਹੁੰਦਾ ਤਾਂ ਉਹ ਆਪਣੇ ਰੈਡ ਕਾਰਡ ਜਾਂ ਗ੍ਰੀਨ ਕਾਰਡ ਦੇ ਕੇ ਉਸ ਬੰਦੇ ਨੂੰ ਚੈਪੀਅਨਸ਼ਿਪ ਤੋਂ ਬਾਹਰ ਕਰ ਸਕਦਾ ਹੈ ਇਸ ਮੁਕਾਬਲੇ ਵਿੱਚ ਕੋਈ ਵੀ ਚੀਟਿੰਗ ਵਗੈਰਾ ਨਹੀਂ ਹੁੰਦੀ ਹੈਗੀ ਠੀਕ ਹੈ ਅਤੇ ਇਹ ਮੁਕਾਬਲੇ ਸਭ ਜੂਨੀਅਰ ਜੂਨੀਅਰ ਲੈਵਲ ਜੂਨੀਅਰ ਯੂਥ ਗੇਮਸ ਖੇਲੋ ਇੰਡੀਆ ਯੂਥ ਗੇਮਸ ਯੂਨੀਵਰਸਿਟੀ ਗੇਮਸ ਸਾਰਿਆਂ ਵਿੱਚ ਖੇਡੀਆਂ ਜਾਂਦੀਆਂ ਹਨ ਗੱਤਕੇ ਦੀ ਬਹੁਤ ਹੀ ਮਹੱਤਵਪੂਰਨ ਹੈ ਇਹ ਸਾਡੇ ਸਿੱਖ ਧਰਮ ਨੂੰ ਦਰਸਾਉਂਦਾ ਹੈ ਸਿੱਖ ਧਰਮ ਨੂੰ ਦਰਸਾਉਂਦਾ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਦਾ ਹੈ ਅਤੇ ਬੱਚਿਆਂ ਨੂੰ ਸੈਲਫ ਡਿਵੈਂਸ ਵੀ ਸਿਖਾਉਂਦਾ ਹੈ ਕਿਵੇਂ ਬੱਚਿਆਂ ਨੇ ਦੁ ਕਿਸੇ ਕੋਈ ਬੰਦਾ ਅਗਰ ਉਹਨਾਂ ਨੂੰ ਮਾਰਨ ਆ ਰਿਹਾ ਤਾਂ ਬੱਚਿਆਂ ਨੇ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਉਹ ਸਿਖਾਉਂਦਾ ਹੈ ਅਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਨੀਲੇ ਬਾਣੇ ਪਾ ਕੇ ਦਸਤਾਰਾਂ ਬੰਨ ਕੇ ਬੱਚੇ ਇਸ ਗੇਮ ਨੂੰ ਖੇਡਦੇ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਖੇਡ ਨੂੰ ਖੇਡਿਆ ਜਾਂਦਾ ਹੈ ਪੂਰੇ ਰਿਸਪੈਕਟਫੁਲ ਮਾਮਲੇ ਰਿਸਪੈਕਟਫੁਲ ਨਾਲ ਖੇਡਿਆ ਜਾਂਦਾ ਹੈ